ਹਾਂਜੀ ਦੌੜਨਾ ਕੋਈ ਮੇਰਾ ਪੇਸ਼ਾ ਨਹੀਂ ਸਗੋਂ ਇੱਕ ਸ਼ੌਕ ਹੈਗਾ ਮੈਨੂੰ ਦੌੜਨਾ ਇਸ ਲਈ ਪਸੰਦ ਹੈ ਕਿ ਜਿਹੜਾ ਸਰੀਰ ਹੈ ਨਾ ਆਪਣਾ ਵੀ ਵਧੀਆ ਰਹਿੰਦਾ ਜੇ ਆਪਾਂ ਰਨਿੰਗ ਕਰਦੇ ਹਾਂ ਡੇਲੀ ਤਾਂ ਨਾ ਤਾਂ ਪੇਟ ਬਾਹਰ ਨੂੰ ਆਵੇ ਸਰੀਰ ਆਪਣਾ ਪੂਰਾ ਐਕਟਿਵ ਰਹਿੰਦਾ ਆਪਣੀ ਫੁੱਲ ਬਾਡੀ ਹੀ ਐਕਟਿਵ ਰਹਿੰਦੀ ਹੈਗੀ ਇਸ ਲਈ ਦੌੜਨਾ ਤਾਂ ਸਾਰਿਆਂ ਨੂੰ ਹੀ ਚਾਹੀਦਾ ਗਾ ਦੌੜਨ ਦੇ ਵਿੱਚ ਮੇਰੀਆਂ ਪ੍ਰਾਪਤੀਆਂ ਦੇ ਬਾਰੇ ਮੈਂ ਤੁਹਾਨੂੰ ਕੀ ਦੱਸਾਂ ਵੀ ਜਿਹੜੀ ਮੇਰੇ ਆ ਸਰੀਰ ਹੈ ਮੈਨੂੰ ਇੰਨਾ ਵਧੀਆ ਲੱਗਦਾ ਮੇਰੀ ਏਜ਼ ਭਾਵੇਂ ਫੋਰਟੀ ਫੋਰ ਹੈ ਚੁਤਾਲੀ ਸਾਲ ਦੀ ਹੈ ਪਰ ਦੇਖਣ ਦੇ ਵਿੱਚ ਮੈਂ ਸਾਰਾ ਪੱਚੀ ਛੱਬੀ ਸਾਲ ਦਾ ਹੀ ਲੱਗਦਾ ਹੈਗਾ ਕਿਉਂਕਿ ਜਿਹੜਾ ਮੇਰਾ ਸਰੀਰ ਹੈ ਵਿਕਾਸ ਹੈ ਇੰਨਾ ਵਧੀਆ ਹੋਏ ਕਿਉਂਕਿ ਮੈਂ ਦੌੜਦਾ ਸੀ ਦੌੜਨ ਕਰਕੇ ਨਾ ਤਾਂ ਮੇਰਾ ਪੇਟ ਬਾਹਰ ਨੂੰ ਆਏ ਮੈਂ ਹਾਲੇ ਵੀ ਅ ਮੁੰਡਿਆਂ ਜਿਹੇ ਵਾਂਗੂੰ ਲੱ ਲੱਗਦਾ ਗਾ ਭਾਵੇਂ ਚੁਤਾਲੀ ਸਾਲ ਮੇਰੀ ਏਜ ਹੈਗੀ ਤਾਂ ਜਿਹੜਾ ਕਿ ਆ ਦੌੜਨਾ ਹਰ ਇੱਕ ਨੂੰ ਚਾਹੀਦਾ ਸਵੇਰੇ ਸ਼ਾਮ ਘੱਟੋ ਘੱਟ ਅੱਧਾ ਘੰਟਾ ਤਾਂ ਜ਼ਰੂਰੀ ਆ ਵੀ ਆਪਾਂ ਹਲਕਾ ਹਲਕਾ ਦੌੜੋ ਵੀ ਕੋਈ ਜ਼ਰੂਰੀ ਥੋੜ੍ਹਾ ਵੀ ਆਪਾਂ ਸਪੀਡਾਂ ਹੀ ਲਾਉਣੀਆਂ ਹੈਗੀਆਂ ਪੂਰੇ ਜ਼ੋਰ ਦੀ ਆਪਾਂ ਕਿਹੜਾ ਕੋਈ ਉਹ ਰੇਸ ਜਿੱਤ ਕੇ ਲੈ ਕੇ ਆਉਣੀ ਆ ਨਹੀਂ ਆਪਦੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਾਨੂੰ ਹਲਕਾ ਫੁਲਕਾ ਜੋਗਿੰਗ ਟਾਈਪ ਹੈ ਜਿਹੜਾ ਦੌੜਨਾ ਚਾਹੀਦਾ ਹੈਗਾ ਜੇ ਵੱਧ ਤੇਜ਼ ਦੌੜ ਲਾਵਾਂਗੇ ਉਹਦਾ ਵੀ ਫਾਇਦਾ ਹੈਗਾ ਪਰ ਨਹੀਂ ਥੋੜ੍ਹਾ ਬਹੁਤਾ ਦੌੜਨਾ ਸਾਰਿਆਂ ਨੂੰ ਚਾਹੀਦਾ ਤਾਂ ਕਿ ਅਸੀਂ ਆਪਦੇ ਸਰੀਰ ਨੂੰ ਫਿਟ ਰੱਖ ਸ਼ ਰਕ ਰੱਖ ਸਕੀਏ ਇਹਦੇ ਨਾਲ ਕਿ ਸਾਡਾ ਸ ਸਟੈਮਿਨਾ ਵ ਵੱਧਦਾ ਹੈਗਾ ਸਾਡੀ ਜਿਹੜੀ ਸ਼ਕਤੀ ਹੈਗੀ ਸਰੀਰ ਦੀ ਸ਼ਕਤੀ ਦਿਮਾਗ ਦੀ ਸ਼ਕਤੀ ਸਾਰੀਆਂ ਸ਼ਕਤੀਆਂ ਦੇ ਵਿੱਚ ਵਾਧਾ ਹੁੰਦਾ ਹੈਗਾ ਇਸ ਲਈ ਮੈਂ ਤਾਂ ਇਹੀ ਸਲਾਹ ਦੇਊਂਗਾ ਕਿ ਵੀ ਸਾਰਿਆਂ ਨੂੰ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਦੌੜਨਾ ਜ਼ਰੂਰ ਚਾਹੀਦਾ ਹੈਗਾ ਦੌੜਨ ਦੇ ਨਾਲ ਜਿਹੜਾ ਸਾਡਾ ਸਰੀਰ ਹੈ ਤੰਦਰੁਸਤ ਰਹਿੰਦਾ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲਦਾ ਹੈਗਾ ਅਤੇ ਬਸ ਸਾਰਾ ਦਿਨ ਜੀਅ ਜਿਹਾ ਲੱਗਿਆ ਰਹਿੰਦਾ ਹੈਗਾ ਭਾਵ ਸਰੀਰ ਦੇ ਵਿੱਚ ਨੇਸਤਾ ਨਹੀਂ ਆਉਂਦੀ ਭਾਵ ਅਸੀਂ ਲੇਜੀ ਨਹੀਂ ਫੀਲ ਕਰਦੇ ਸਗੋਂ ਸਾਰਾ ਦਿਨ ਸਾਡੀਆਂ ਜਿਹੜੀਆਂ ਡੇਲੀ ਕਿਰਿਆਵਾਂ ਹੁੰਦੀਆਂ ਉਹ ਵੀ ਪੂਰੀਆਂ ਐਕਟਿਵ ਹੁੰਦੀਆਂ ਦੌੜਨ ਦੇ ਨਾਲ ਤਾਂ ਫਿਰ ਸਾਰਿਆਂ ਨੂੰ ਇਹੀ ਸਲਾਹ ਕਿ ਪਲੀਜ਼ ਅੱਧਾ ਘੰਟਾ ਜ਼ਰੂਰ ਦੌੜੋ